ਨਮਸਕਾਰ ਹਾਂਜੀ ਹਾਂਜੀ ਸਰ ਬੋਲੀਏ ਸਰ ਤੁਹਾਨੂੰ ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਆਪਣੀ ਜ਼ਿੰਦਗੀ ਦਾ ਪਾਰਟ ਹੀ ਹੈ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਆਪਣੀ ਲਾਈਫ 'ਚ ਸਕਸੈਸਫੁੱਲ ਹੁੰਦਾ ਹੈ ਕਾਮਯਾਬ ਹੁੰਦਾ ਹੈ ਕਦੇ ਨਾ ਕਦੇ ਆਪਾਂ ਕੋਸ਼ਿਸ਼ ਕਰਨ ਨਾਲ ਜ਼ਰੂਰ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਵਾਂਗੇ ਜੇ ਆਪਾਂ ਜ਼ਿਆਦਾ ਟੈਨਸ਼ਨ ਲਾਂਗੇ ਜਾਂ ਪ੍ਰੇਸ਼ਾਨ ਹੋਵਾਂਗੇ ਤਾਂ ਆਪਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ ਜੀ ਆਪਾਂ ਨੂੰ ਹਮੇਸ਼ਾਂ ਸਕਾਰਾਤਮਕ ਰਵੱਈਆ ਰੱਖਣਾ ਚਾਹੀਦੀ ਅਤੇ ਅੱਗੇ ਵੱਧਣਾ ਚਾਹੀਦੀ ਕਦੇ ਵੀ ਨੈਗੇਟਿਵ ਸੋਚ ਦਿਮਾਗ ਵਿੱਚ ਨਹੀਂ ਆਉਣੀ ਚਾਹੀਦੀ ਨਹੀਂ ਸਰ ਜੇ ਤੁਸੀਂ ਆਪਣਾ ਧਿਆਨ ਕਿਸੇ ਦੂਸਰੇ ਕੰਮ ਵੱਲ ਲਗਾਓਗੇ ਦੂਸਰੀਆਂ ਚੀਜ਼ਾਂ ਵੱਲ ਕਰੋਗੇ ਤਾਂ ਤੁਹਾਡੇ ਮਨ 'ਚ ਅਜਿਹੇ ਵਿਚਾਰ ਨਹੀਂ ਆਉਣਗੇ ਤੁਸੀਂ ਆਪਣਾ ਧਿਆਨ ਆਪ ਸ਼ੁਰੂ ਕਰ ਦਿਓ ਅਤੇ ਤੁਹਾਡੀਆਂ ਉਹ ਹੱਲ ਹੋ ਜਾਣਗੀਆਂ ਪ੍ਰੋਬਲਮ ਸਰ ਇੱਕ ਤਾਂ ਤੁਸੀਂ ਗੁੱਸੇ 'ਤੇ ਕੰਟਰੋਲ ਕਰੋ ਆਪਣੇ ਉਸਨੂੰ ਜ਼ਿਆਦਾ ਮਤਲਬ ਧਿਆਨ ਨਾਲ ਆਪਣੇ ਮਾਈਂਡ ਨੂੰ ਸੈੱਟ ਕਰੋ ਓਕੇ ਸਰ